ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਤੁਸੀਂ ਸ਼ਾਮਾ ਢਾਬਾ ਤੋਂ ਬੋਲਦੇ ਹੋ ਮੈਂ ਤੁਹਾਡੇ ਢਾਬੇ ਤੋਂ ਖਾਣਾ ਔਡਰ ਕੀਤਾ ਸੀ ਮੈਂ ਖਾਣੇ ਵਿੱਚ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਤੰਦੂਰੀ ਰੋਟੀ ਔਡਰ ਕੀਤੀ ਸੀ ਪਰ ਬਾਹਰ ਮੌਸਮ ਬਹੁਤ ਖਰਾਬ ਸੀ ਮੌਸਮ ਖਰਾਬ ਹੋਣ ਦੇ ਕਾਰਨ ਮੌਸਮ ਹੋਣ ਦੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਤੁਹਾਡੇ ਡਿਲੀਵਰੀ ਪਾਰਟਨਰ ਨੇ ਮੈਨੂੰ ਪੂਰੇ ਟਾਈਮ ਪਰ ਖਾਣਾ ਪਹੁੰਚਾ ਦਿੱਤਾ ਮੈਨੂੰ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਸਰਵ ਸਰ ਡਿਲੀਵਰੀ ਕਰਨ ਵਾਲ਼ਾ ਪਾਰਟਨਰ ਵੀ ਤੁਹਾਡਾ ਬਹੁਤ ਵਧੀਆ ਸੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੀ ਸਰਵਿਸ ਦੇਖ ਕੇ ਥੈਂਕ ਯੂ